ਸਤਿ ਸ਼੍ਰੀ ਅਕਾਲ ਕੀ ਮੈਂ ਪੈਨ ਕਾਰਡ ਗ੍ਰਾਹਕ ਸੇਵਾ ਅਧਿਕਾਰੀ ਤੋਂ ਗੱਲ ਕਰ ਰਹੀ ਹਾਂ ਮੈਂ ਇਹ ਪੁੱਛਣ ਲਈ ਫੋਨ ਕੀਤਾ ਹੈ ਕਿ ਮੈਂ ਹੁਣ ਇੱਕ ਨਵੇਂ ਸ਼ਹਿਰ ਵਿੱਚ ਚਲੀ ਗਈ ਹਾਂ ਅਤੇ ਮੈਨੂੰ ਆਪਣੇ ਪੈਨ ਕਾਰਡ ਦਾ ਪਤਾ ਚੇਂਜ ਕਰਵਾਉਣਾ ਹੈ ਇਸ ਲਈ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਸ ਦੇ ਕੀ ਕੀ ਪੜਾਅ ਹੋ ਸਕਦੇ ਹਨ ਅਰ ਅਤੇ ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ ਡ੍ਰਾਈਵਿੰਗ ਲਾਈਸੈਂਸ ਆਦਿ ਬਾਰੇ ਵੀ ਦੱਸ ਸਕਦੇ ਹੋ ਕਿ ਮੈਨੂੰ ਕਿਹੜੇ ਕਿਹੜੇ ਦਸਤਾਵੇਜ਼ਾਂ ਦੀ ਲੋੜ ਪੈ ਸਕਦੀ ਹੈ ਧੰਨਵਾਦ ਜੀ